ਸਾਡਾ ਧਰਮ ਸਾਨੂੰ ਸਿਹਤ ਬਾ ਸਿਹਤ ਸੰਭਾਲ ਬਾਰੇ ਵੀ ਸਿਖਾਉਂਦਾ ਹੈ ਜਿਵੇਂ ਅਸੀਂ ਸਵੇਰੇ ਸਾਜਰੇ ਉੱਠ ਕੇ ਨਹਾ ਧੋ ਕੇ ਸੈਰ ਸਪਾਟਾ ਕਰਕੇ ਅਸੀਂ ਆਪਣੇ ਪਾਠ ਵੱਲ ਬੈਠ ਜਾਂਦੇ ਹਾਂ ਜਿਸ ਕਰਕੇ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਇਹ ਸਾਨੂੰ ਸੰਤੁਲਿਤ ਭੋਜਨ ਖਾਣ ਬਾਰੇ ਵੀ ਪ੍ਰੇਰਿਤ ਕਰਦਾ ਹੈ ਜਿਸ ਨਾਲ਼ ਖਾ ਕੇ ਅਸੀਂ ਠੀਕ ਰਹਿ ਸਕਦੇ ਹਾਂ ਅਤੇ ਅਪ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹਾਂ